ਹੈਲੋ ਹਾਂਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਂ ਹਾਂਜੀ ਮੈਮ ਮੈਂ ਨਾ ਗ੍ਰੈਜੂਏਸ਼ਨ ਕੀਤੀ ਸੀਗੀ ਮੈਨੇ ਪੰਜਾਬੀ ਯੂਨੀਵਰਸਿਟੀ ਇਹ ਪੁੱਛਣਾ ਸੀ ਕੀ ਕਿਹੜੇ ਕਿਹੜੇ ਕੋਰਸਿਸ ਅਵੇਲੇਬਲ ਨੇ

ਮੈਂ ਗ੍ਰੈਜੂਏਸ਼ਨ ਹੈਗਾ ਸੀ ਮੇਰੇ ਕੋਲ ਹਿੰਦੀ ਇਲੈਕਟਿਵ ਅਤੇ ਹਿਸਟਰੀ ਅਤੇ ਪੋਲੀਟੀਕਲ ਸਾਇੰਸ ਹਾਂਜੀ ਓਕੇ ਹਾਂਜੀ ਓਕੇ ਹਾਂਜੀ ਹਾਂਜੀ ਮੈਮ ਜਿਵੇਂ ਨਾ ਮੇਰੇ ਬਰਦਰ ਲੋਇਰ ਨੇ ਮੈਂ ਸੋਚ ਰਹੀ ਸੀ ਜਿਵੇਂ ਐੱਲ ਐੱਲ ਬੀ ਵਗੈਰਾ ਹੈ ਅੱਛਾ ਜੀ ਓਕੇ ਠੀਕ ਹੈ ਮਤਲਬ ਕਿਉਂਕਿ ਮੈਨੂੰ ਐਵੇਂ ਸੀ ਨਾ ਬਰਦਰ ਲੋਇਰ ਸੀਗਾ ਅਤੇ ਮੈਨੂੰ ਐਂ ਸੀ ਵੀ ਮੈਂ ਐੱਲ ਐੱਲ ਬੀ ਕਰ ਲਾਂ ਫਿਰ ਤਾਂ ਮੇਰੀ ਥਰੀ ਈਅਰਜ ਵੀ ਹੋ ਜਾਏਗੀ ਹੈ ਨਾ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਅਤੇ ਇਹਨਾਂ ਦੀ ਮੈਮ ਥੋੜ੍ਹੀ ਜੀ ਉਹ ਦੱਸ ਦਿਓ ਮੈਨੂੰ ਐਡਮਿਸ਼ਨ ਡੇਟ ਅਤੇ ਫੋਰਮਸ ਵਗੈਰਾ ਦੀ ਕੀ ਉਹ ਹੈ ਰਿਕੁਆਇਰਮੈਂਟ ਹੈ ਹਾਂਜੀ ਓਕੇ ਠੀਕ ਹੈ ਮੈਮ ਚਲੋ ਮੈਂ ਵੈਬਸਾਈਟ ਵਿਜਿਟ ਕਰ ਲਉਂਗੀ ਅਤੇ ਬਾਕੀ ਮੈਨੂੰ ਟੈਕਸਟ ਕਰ ਦਿਓ ਮੈਸੇਜ ਹੈ ਨਾ ਤਾਂ ਮੈਂ ਦੇਖ ਲਉਂਗੀ ਹਾਂਜੀ ਥੈਂਕ ਯੂ ਮੈਮ ਥੈਂਕ ਯੂ ਓਕੇ